ਭਾਰਤ ਸਰਕਾਰ ਵੱਲੋਂ ਮਤਲਬ ਕਈ ਸਕੀਮਾਂ ਹਨ ਪਰ ਮੈਨੂੰ ਦੋ ਹੀ ਸਕੀਮਾਂ ਦਾ ਨਾਂ ਪਤਾ ਹਨ ਇੱਕ ਮੋਦੀ ਪੰਜ ਲੱਖ ਕਾਰਡ ਵਾਲੀ ਅਤੇ ਭਾਈ ਘਨ੍ਹੱਈਆ ਜੀ ਦੀ ਮਤਲਬ ਕਿਸਮ ਦੀ ਇਲਾਜ ਵਾਲੀ ਇਹ ਦੋ ਦੋਨੇਂ ਸਕੀਮਾਂ ਮਤਲਬ ਉਹਨਾਂ ਵਾਸਤੇ ਹਨ ਜਿਹੜੇ ਗ਼ਰੀਬ ਹੁੰਦੇ ਹਨ ਅਤੇ ਮਤਲਬ ਇਹ ਕਾਰਡ ਸਾਡਾ ਵੀ ਬਣਿਆ ਹੋਇਆ ਵਾ ਅਤੇ ਅਸੀਂ ਇਹ ਆਪਣੇ ਪਿੰਡ ਦੇ ਕੈਫ਼ੇ ਤੋਂ ਮਤਲਬ ਜਾਰੀ ਕੀਤਾ ਸੀਗਾ ਅਪਲਾਈ ਕੀਤਾ ਸੀਗਾ ਅਤੇ ਮਤਲਬ ਇਹ ਸਾਨੂੰ ਮਤਲਬ ਇਹਨਾਂ ਦੇ ਵਿੱਚ ਇਲਾਜ ਸਾਡਾ ਫ੍ਰੀ ਹੋ ਸਕਦਾ ਹੈ ਅਤੇ ਇਹਦੇ ਵਿੱਚ ਮਤਲਬ ਸਾਨੂੰ ਦਵਾਈਆਂ ਦਵੁਈਆਂ ਦਾ ਵੀ ਕੋਈ ਚੱਕਰ ਨਹੀਂ ਪੈਂਦਾ ਹੈਗਾ ਸਾਨੂੰ ਦਵਾਈਆਂ ਫ੍ਰੀ ਮਿਲ ਜਾਂਦੀਆਂ ਹਨ ਅਤੇ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਹ ਮਤਲਬ ਸਰਕਾਰੀ ਜਾਂ ਪ੍ਰਾਈਵੇਟ ਹੋਵੇ ਦੋਨਾਂ ਦੇ ਵਿੱਚ ਇਹ ਕਾਰਡ ਚੱਲ ਜਾਂਦਾ ਅਤੇ ਦੋਨਾਂ ਦੇ ਵਿੱਚ ਫ੍ਰੀ ਇਲਾਜ ਹੋ ਜਾਂਦਾ ਹੈ ਅਤੇ ਦੋਨਾਂ ਦੇ ਵਿੱਚ ਓਪਰੇਸ਼ਨ ਵੀ ਹੁੰਦੇ ਸਾਰਾ ਕੁਛ ਹੋ ਜਾਂਦਾ ਹੈ ਅਤੇ ਇਹ ਕਾਰਡ ਮਤਲਬ ਉਹਨਾਂ ਵਾਸਤੇ ਹੁੰਦਾ ਜਿਨ੍ਹਾਂ ਦੀ ਤਨਖ਼ਾਹ ਅੱਸੀ ਹਜ਼ਾਰ ਤੋਂ ਘੱਟ ਹੁੰਦੀ ਹੈ ਅਤੇ ਮਤਲਬ ਗ਼ਰੀਬ ਹੁੰਦੇ ਹੈ ਅਤੇ ਫਿਰ ਮਤਲਬ ਇਹ ਗ਼ਰੀਬਾਂ ਵਾਸਤੇ ਜ਼ਿਆਦਾ ਮਤਲਬ ਬਣਿਆ ਹੈ ਅਤੇ ਉਹਨਾਂ ਨੂੰ ਹੀ ਇਹ ਕਰਨਾ ਚਾਹੀਦਾ ਬਾਕੀ ਹੋਰ ਬੰਦਿਆਂ ਵਾਸਤੇ ਹੈ ਨਹੀਂ ਕਿਉਂਕਿ ਗ਼ਰੀਬ ਗ਼ਰੀਬ ਬੰਦਿਆਂ ਨੂੰ ਇਸਦੀ ਜ਼ਿਆਦਾ ਲੋੜ ਹੈ ਅਤੇ ਇਹ ਉਹਨਾਂ ਨੂੰ ਹੀ ਅਪਲਾਈ ਕਰਨਾ ਚਾਹੀਦਾ